ਨਮਸਕਾਰ ਸਰ ਜੀ ਮੇਰਾ ਨਾਮ ਪੂਜਾ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਆਪਣੇ ਬਚਪਨ ਦੀਆਂ ਯਾਦਾਂ ਨੂੰ ਸਾਂਝੀਆਂ ਕਰ ਰਹੀ ਹਾਂ ਅਸੀਂ ਆਪਣੇ ਨਾਨਕੇ ਘਰ ਜਾਂਦੇ ਸਾਂ ਉੱਥੇ ਅਸੀਂ ਅਲੱਗ ਅਲੱਗ ਜਗ੍ਹਾ 'ਤੇ ਘੁੰਮਣਾ ਫਿਰਨਾ ਪਸੰਦ ਕਰਦੇ ਸਾਂ ਅਸੀਂ ਉੱਥੇ ਦੀ ਇੱਕ ਬਹੁਤ ਹੀ